ਮੈਂ ਪੰਜਾਬ ਦਾ ਰਹਿਣ ਵਾਲਾ ਨ ਨਿਵਾਸੀ ਹਾਂ ਮੈਂ ਇੱਕ ਦਿਨ ਕਿਸੇ ਬਾਗ ਵਿੱਚ ਵੈਸੇ ਹੀ ਘੁੰਮਦਾ ਪਿਆ ਸੀ ਪਰ ਉੱਥੇ ਮੇਰੇ ਇੱਕ ਸ਼ੂਟਿੰਗ ਸਟਾਰ 'ਤੇ ਨਜ਼ਰ ਪੈ ਗਈ ਉਹ ਇੱਕ ਮਸ਼ਹੂਰ ਸ਼ੂਟਿੰਗ ਸਟਾਰ ਸੀ ਜੋ ਆਪਣੀ ਸ਼ੂਟਿੰਗ ਇੱਥੇ ਕਰ ਰਿਹਾ ਸੀ ਸ਼ੂਟਿੰਗ ਤਾਂ ਬਹੁਤ ਵਧੀਆ ਕਰ ਰਿਹਾ ਸੀ ਪਰ ਉਸਦੇ ਨਾਲ ਵੀ ਉਹ ਸਾਰਿਆਂ ਨਾਲ ਮਿਲ ਵਰਤ ਵੀ ਰਿਹਾ ਸੀ ਮੈਂ ਹੌਲੀ ਹੌਲੀ ਉਸਦੇ ਕੋਲ ਜਾ ਪੁੱਜਾ ਪਰ ਉਹ ਬਹੁਤ ਬਿਜ਼ੀ ਸੀ ਪਰ ਉਸਨੇ ਮੇਰੇ ਵੱਲ ਵੀ ਜ਼ਰੂਰ ਧਿਆਨ ਦਿੱਤਾ ਉਹ ਮੇਰਾ ਸਭ ਤੋਂ ਹਰਮਨ ਪਿਆਰਾ ਅਤੇ ਵਧੀਆ ਸ਼ੂਟਿੰਗ ਸਟਾਰ ਸੀ ਜਿਸਦੀ ਫਿਲਮਾਂ ਗਾਣੇ ਮੈਂ ਰੋਜ਼ ਆਪਣੇ ਟੀ ਵੀ ਜਾਂ ਮੋਬਾਈਲ ਵਿੱਚ ਲਾ ਰੱਖਦਾ ਸੀ ਉਹ ਸ਼ੂਟਿੰਗ ਸਟਾਰ ਤੋਂ ਮੈਂ ਇੱਕ ਇੱਕ ਹੀ ਚੀਜ਼ ਮੰਗੀ ਉਸਦਾ ਆਟੋਗਰਾਫ ਜਿਸ ਰਾਹੀਂ ਮੈਂ ਉਸਦੀ ਯਾਦ ਤਾਂ ਜ਼ਰੂਰ ਰੱਖ ਪਾਊਂਗਾ ਪਰ ਇੱਕ ਪਲ ਵੀ ਰਹੂਗਾ ਅਤੇ ਉਸ ਨਾਲ ਮੈਂ ਇੱਕ ਫੋਟੋ ਵੀ ਖਿਚਵਾਈ ਜਿਸਦਾ ਸਬੂਤ ਮੈਂ ਆਪਣੇ ਦੋਸਤਾਂ ਨੂੰ ਦਿਖਾਉਂਦਾ ਕਿ ਮੈਂ ਇੱਕ ਸ਼ੂਟਿੰਗ ਸਟਾਰ ਨੂੰ ਮਿਲਿਆ ਪਰ ਇਹ ਸ਼ੂਟਿੰਗ ਸਟਾਰ ਇਹੋ ਜਿਹਾ ਵੀ ਸੀ ਬਟ ਉਹ ਕਿਹੋ ਜਿਹਾ ਵੀ ਸੀ ਪਰ ਮੇਰਾ ਹਰਮਨ ਪਿਆਰਾ ਸੀ ਪਰ ਉਹ ਸ਼ੂਟਿੰਗ ਸਟਾਰ ਇੱਦਾਂ ਦਾ ਵੀ ਨਹੀਂ ਸੀ ਕਿ ਉਹ ਕਿਸੇ ਨੂੰ ਮਿਲਦਾ ਨਹੀਂ ਉਹ ਉਸ ਦਿਨ ਆਪਣੀ ਸ਼ੂਟਿੰਗ ਤਾਂ ਜ਼ਰੂਰ ਦੇਖ ਰਿਹਾ ਕਰ ਰਿਹਾ ਸੀ ਪਰ ਫਿਰ ਵੀ ਉਸਦਾ ਧਿਆਨ ਸਾਰੇ ਲੋਕਾਂ ਵੱਲ ਸੀ ਕਿ ਉਸ ਦਾ ਧਿਆਨ ਵੱਲ ਉਸਨੂੰ ਕੌਣ ਕੌਣ ਦੇਖ ਰਿਹਾ ਹੈ